ਸਾਗ ਪੰਜਾਬ ਦੀ ਸ਼ਾਨ ਪੰਜਾਬ ਵਿੱਚ ਸਭ ਤੋਂ ਮਸ਼ਹੂਰ ਸਾਗ ਔਰ ਮੱਕੀ ਦੀ ਰੋਟੀ ਹੈ ਸਾਗ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸਾਗ ਸਰ੍ਹੋਂ ਦਾ ਸਾਗ ਹੁੰਦਾ ਉਹਨੂੰ ਬਰੀਕ ਬਰੀਕ ਕੱਟਿਆ ਜਾਂਦਾ ਪਾਲਕ ਨੂੰ ਬਰੀਕ ਬਰੀਕ ਕੱਟਿਆ ਜਾਂਦਾ ਸਾਗ ਔਰ ਪਾਲਕ ਨੂੰ ਕੁੱਕਰ ਵਿੱਚ ਪਾ ਕੇ ਵਿੱਚ ਅਦਰਕ ਹਰੀ ਮਿਰਚਾਂ ਤੇਲ ਵਗੈਰਾ ਪਾ ਕੇ ਉਹਨੂੰ ਬੋਇਲ ਕੀਤਾ ਜਾਂਦਾ ਨਮਕ ਪਾ ਕੇ ਜਦੋਂ ਅੱਛੀ ਤਰ੍ਹਾਂ ਪੱਕ ਜਾਂਦਾ ਅਤੇ ਉਹਨੂੰ ਫਿਰ ਪੀਸ ਕੇ ਉਹਨੂੰ ਤੜਕਾ ਦਿੱਤਾ ਜਾਂਦਾ ਹੈ ਲਸਣ ਦਾ ਮਿਰਚਾਂ ਦਾ ਤੜਕਾ ਦੇ ਕੇ ਉਹਦੇ ਵਿੱਚ ਮੱਖਣ ਪਾਇਆ ਜਾਂਦਾ ਹੈ ਪੰਜਾਬੀਆਂ ਦੀ ਸਭ ਤੋਂ ਮਸ਼ਹੂਰ ਹੈ ਸਰ੍ਹੋਂ ਦਾ ਸਾਗ ਔਰ ਮੱਕੀ ਦੀ ਰੋਟੀ ਔਰ ਪੰਜਾਬ ਦੀ ਸਭ ਤੋਂ ਮਸ਼ਹੂਰ ਇੱਕ ਔਰ ਡਿਸ਼ ਹੈ ਉਹ ਹੈ ਦਾਲ ਚਾਵਲ ਮਾਣੀ ਚਣੇ ਦੀ ਦਾਲ ਨੂੰ ਬੋਇਲ ਕਰਕੇ ਇਹਦੇ ਵਿੱਚ ਸੌਂਫ ਨਮਕ ਹਲਦੀ ਮਿਰਚ ਡਾ ਤੇਲ ਡਾਲ ਕੇ ਉਹਨੂੰ ਬੋਇਲ ਕੀਤਾ ਜਾਂਦਾ ਹੈ ਬਾਅਦ 'ਚ ਉਹਨੂੰ ਮਿਰਚਾਂ ਦਾ ਤੜਕਾ ਦਿੱਤਾ ਜਾਂਦਾ ਉਹਦੇ ਨਾਲ ਖੱਟਾ ਬਣਾਇਆ ਜਾਂਦਾ ਇਮਲੀ ਦਾ ਖੱਟਾ ਹੁੰਦਾ ਇਮਲੀ ਨੂੰ ਭਿਗੋ ਕੇ ਉਹਨੂੰ ਮੇਥਿਆਂ ਦਾ ਤੜਕਾ ਦੇ ਕੇ ਇਮਲੀ ਦੇ ਪਾਣੀ ਦੇ ਵਿੱਚ ਬੇਸਣ ਪਾ ਕੇ ਉਹਨੂੰ ਮਿਰਚਾਂ ਦਾ ਤੜਕਾ ਦੇ ਕੇ ਫਿਰ ਉਹਦੇ ਉਹਨੂੰ ਬੜਕਾਇਆ ਜਾਂਦਾ ਉਹਦੇ ਵਿੱਚ ਗੁੜ ਪਾਇਆ ਜਾਂਦਾ ਔਰ ਉਹਨੂੰ ਚੰਗੀ ਤਰ੍ਹਾਂ ਕਾੜ੍ਹਿਆ ਜਾਂਦਾ ਹੈ ਕੜ੍ਹ ਕੜ੍ਹ ਕੇ ਜਦੋਂ ਉਹ ਤਿਆਰ ਹੋ ਜਾਂਦਾ ਅਤੇ ਉਹ ਬਹੁਤ ਟੇਸਟੀ ਹੁੰਦਾ ਦਾਲ ਚਾਵਲ ਮਾਣੀ ਪੰਜਾਬੀਆਂ ਦੀ ਸ਼ਾਨ ਹੈ